ਮੋਹਾਲੀ ਜ਼ਿਲ੍ਹੇ ਵਿੱਚ ਸਮੇਂ ਸਮੇਂ ਸਿਰ ਪ੍ਰਸ਼ਾਸਨ ਵੱਲੋਂ ਵੱਖ ਵੱਖ ਤਰੀਕੇ ਦੇ ਨਾਲ ਤਿਉਹਾਰ ਸੱਭਿਆਚਾਰਕ ਮੇਲੇ ਆਦਿ ਮਨਾਏ ਜਾਂਦੇ ਹਨ ਜਿਸ ਵਿੱਚ ਹਰ ਵਰਗ ਦੇ ਲੋਕ ਹਰ ਨਸਲ ਦੇ ਲੋਕ ਹਰ ਧਰਮ ਦੇ ਲੋਕ ਇਕੱਠੇ ਹੁੰਦੇ ਹਨ ਅਤੇ ਇਹ ਸਭ ਪਿਆਰ ਦੇ ਨਾਲ ਆਪਸੀ ਸਾਂਝ ਦੇ ਨਾਲ ਇਹ ਸਭ ਮਨਾਉਂਦੇ ਹਨ ਅਤੇ ਜਿਸ ਨਾਲ ਇਹਨਾਂ ਦੀ ਆਪਸੀ ਸਾਂਝ ਵੱਧਦੀ ਹੈ ਅਤੇ ਭਾਈਚਾਰਕ ਸਾਂਝ ਵੀ ਵੱਧਦੀ ਹੈ